ਮੈਂ ਅੰਸ਼ੂਲ ਮੈਂ ਪਠਾਨਕੋਟ ਦਾ ਰਹਿਣ ਵਾਲਾ ਹਾਂ ਵੈਸੇ ਜੇ ਮੈਂ ਗੱਲ ਕਰਾਂ ਕਿ ਤਿਉਹਾਰਾਂ ਜਾਂ ਧਾਰਮਿਕ ਮੌਕਿਆਂ ਲਈ ਦੇਵੀ ਦੇਵਤਿਆਂ ਦੀ ਮੂਰਤੀਆਂ ਦੇ ਅਤੇ ਇੰਝ ਵੈਸੇ ਮੈਂ ਮੂਰਤੀਆਂ ਤਾਂ ਵੈਸੇ ਮੈਂ ਘੱਟ ਹੀ ਬਣਾਉਂਦਾ ਪਰ ਜੇ ਮੈਂ ਗੱਲ ਕਰਾਂ ਕਿ ਜਿਵੇਂ ਕੋਈ ਜਿੱਦਾਂ ਤਿਉਹਾਰ ਆਉਂਦਾ ਕਿ ਜਿੱਦਾਂ ਇੱਕ ਵਾਰ ਜਿੱਦਾਂ ਪਿਛਲੇ ਸਾਲ ਦੀ ਮੈਂ ਗੱਲ ਕਰਾਂ ਤਾਂ ਜਿੱਦਾਂ ਗਣੇਸ਼ ਚਤੁਰਥੀ ਆਈ ਸੀ ਅਤੇ ਉਦੋਂ ਮੈਂ ਗਣੇਸ਼ ਦੀ ਮੂਰਤੀ ਬਣਾਈ ਸੀ ਜਿਸ ਵਿੱਚ ਮੈਂ ਕਲੇਅ ਦਾ ਇਸਤੇਮਾਲ ਕੀਤਾ ਸੀ ਅਤੇ ਉਹ ਮੂਰਤੀ ਬਣਾਉਣ ਲਈ ਮੈਂ ਯੂਟੀਊਬ ਵਰਗੀਆਂ ਕੁਝ ਐਪਸ ਦਾ ਇਸਤੇਮਾਲ ਕੀਤਾ ਜਿੱਥੋਂ ਮੈਂ ਖੁਦ ਸਿੱਖਿਆ ਕਿ ਕਿੱਦਾਂ ਬਣਾਉਣੀਆਂ ਜਾਂ ਕਿੱਦਾਂ ਸ਼ੁਰੂਆਤ ਕਰਨੀ ਆ ਤਾਂ ਕਲੇਅ ਨੂੰ ਮਤਲਬ ਕਿੱਦਾਂ ਮੋਲਡ ਕੀਤਾ ਕਿ ਕਿੱਦਾਂ ਉਹਦਾ ਸ਼ੇਪ ਬਦਲਿਆ ਅਤੇ ਫਿਰ ਉਸ ਨੂੰ ਜੋੜ ਕੇ ਮੈਂ ਸ਼੍ਰੀ ਗਣੇਸ਼ ਜੀ ਦੀ ਮੂਰਤੀ ਬਣਾਈ ਸੀ ਤਾਂ ਉਹ ਅਨੁਭਵ ਮੇਰਾ ਬਹੁਤ ਹੀ ਚੰਗਾ ਰਿਹਾ ਸੀ ਅਤੇ ਮੈਂ ਆਸ਼ਾ ਕਰਦਾ ਹਾਂ ਕਿ ਅੱਗੇ ਜਾ ਕੇ ਵੀ ਮੈਂ ਕੁਝ ਹੋਰ ਮੂਰਤੀਆਂ ਬਣਾਵਾਂਗਾ ਧੰਨਵਾਦ